ਮੈਂ ਰਿਪਨ ਖੁਸ਼ੀ ਦੇ ਬਲੋਗ ਦੇਖਦੀ ਹਾਂ ਉਹ ਵੱਖ ਵੱਖ ਜਗ੍ਹਾਂ 'ਤੇ ਜਾਂਦੇ ਨੇ ਅਲੱਗ ਅਲੱਗ ਦੇਸ਼ਾਂ ਦੀ ਸੈਰ ਕਰਾਉਂਦੇ ਹਨ ਇੰਝ ਲੱਗਦਾ ਹੈ ਜਿਵੇਂ ਅਸੀਂ ਅਲੱਗ ਅਲੱਗ ਦੇਸ਼ਾਂ ਦੀ ਸੈਰ ਕਰ ਆਈਏ ਮੈਂ ਕੋਈ ਕਹਾਣੀ ਨਹੀਂ ਲਿਖੀ ਮੈਂ ਵੈਸੇ ਹੀ ਛੋਟੀ ਛੋਟੀ ਕਹਾਣੀ ਲਿਖਦੀ ਹਾਂ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਮੈਂ ਪੰਜਾਬੀ ਭਾਸ਼ਾ ਵਿੱਚ ਹੀ ਲਿਖਣਾ ਪਸੰਦ ਕਰਦੀ ਹਾਂ ਮੈਂ ਬੱਚਿਆਂ ਦੀ ਸਟੋਰੀ ਬਣਾ ਬਣਾ ਕੇ ਸੁਣਾਉਂਦੀ ਫਿਰ ਸੁਖ ਫਿਰ ਵੱਖ ਵੱਖ ਮੁੱਦਿਆਂ 'ਤੇ ਬਹੁਤ ਕੁਛ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਹੈ ਉਹ ਵੀ ਸੁਣ ਕੇ ਬੱਚੇ ਮੋਟੀਵੇਟ ਹੁੰਦੇ ਹਨ ਉਹ ਵੀ ਬਹੁਤ ਪ੍ਰਸ਼ੰਸਾ ਕਰਦੇ ਹਨ ਮੰਮੀ ਤੁਸੀਂ ਹਰ ਰੋਜ਼ ਅਲੱਗ ਅਲੱਗ ਜਗ੍ਹਾ ਤੋਂ ਸਾਰਾ ਕੁਛ ਕਿਵੇਂ ਸਿੱਖਦੇ ਹੋ ਅਤੇ ਸਾਨੂੰ ਸੁਣਾਉਂਦੇ ਹੋ ਅਸੀਂ ਸਾਰੇ ਬਹੁਤ ਖੁਸ਼ ਹੁੰਦੇ ਹਾਂ ਇੱਦਾਂ ਦੀਆਂ ਚੀਜ਼ਾਂ ਦੇਖ ਕੇ ਸੁਣ ਕੇ ਪੜ੍ਹ ਕੇ ਸਾਰਾ ਕੁਛ ਬਹੁਤ ਵਧੀਆ ਲੱਗਦਾ ਹੈ ਅਤੇ ਘਰ ਦਾ ਮਾਹੌਲ ਵੀ ਬਹੁਤ ਵਧੀਆ ਰਹਿੰਦਾ